ਵਿਆਹ ਦੇ ਵਿੱਚ ਪਾਣੀ ਦੀ ਵਰਤੋਂ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਪਾਣੀ ਸਾਡੀ ਜ਼ਿੰਦਗੀ ਦਾ ਇੱਕ ਅਨਮੋਲ ਹਿੱਸਾ ਹੈ ਜਿਸ ਦੀ ਵਰਤੋਂ ਸਾਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਪਰ ਵਿਆਹ ਵਰਗੇ ਸਮਾਗਮਾਂ ਵਿੱਚ ਜਿਵੇਂ ਕਿ ਬਰਤਨ ਸਾਫ ਕਰਨੇ ਨਹੋਣਾ ਪੀਣ ਵਾਸਤੇ ਜਾ ਕੇ ਸਬਜੀਆਂ ਫੁਲਕੇ ਆਦੀ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਵਿੱਚ ਅਸੀਂ ਪਾਣੀ ਦੇ ਵੱਡੇ ਟੈਂਕ ਦੀ ਵਰਤੋਂ ਕਰਦੇ ਹਾਂ ਉਹ ਪਾਣੀ ਸਾਡੇ ਬਰਤਨ ਸਾਫ ਕਰਨ ਲਈ ਨਹਾਉਣ ਲਈ ਵਰਤਿਆ ਜਾਂਦਾ ਹੈ ਅਤੇ ਪੀਣ ਵਾਸਤੇ ਪਾਣੀ ਦਾ ਅਸੀਂ ਖਾਸ ਪ੍ਰਬੰਧ ਕਰਦੇ ਹਾਂ ਜਿਵੇਂ ਕਿ ਪਾਣੀ ਦੀਆਂ ਛੋਟੀਆਂ ਬੋਤਲਾਂ ਜਾਂ ਕੱਪ ਆਦੀ ਵੀ ਮਿਲਦੇ ਹਨ ਜੋ ਕਿ ਖਾਣਾ ਖਾਣ ਅਸੀਂ ਉਸਦੀ ਵਰਤੋਂ ਕਰਦੇ ਹਾਂ ਪਾਣੀ ਸਾਨੂੰ ਸਾਡੇ ਲਈ ਇੱਕ ਬਹੁਤ ਹੀ ਮਹੱਤਵ ਚੀਜ਼ ਹੈ ਇਸ ਦੀ ਦੁਰਵਰਤੋਂ ਤਾਂ ਨਹੀਂ ਕਰਨੀ ਚਾਹੀਦੀ ਪਰ ਵਿਆਹ ਵਰਗੇ ਸਮਾਗਮਾਂ ਵਿੱਚ ਕਈ ਵਾਰੀ ਸਾਤੋਂ ਇਸ ਦੁਰਵਰਤੋਂ ਵੀ ਹੋ ਜਾਂਦੀ ਹੈ ਜੋ ਕਿ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਸਾਨੂੰ ਸੋਚ ਸਮਝ ਕੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ